ਵੈਸੇ ਤਾਰਿਆਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਬਹੁਤ ਸਾਰੇ ਮਿਥਸ ਵੀ ਹੈਗੇ ਆ ਇਹਨਾਂ ਵਿੱਚੋਂ ਮੇਰਾ ਪਰਸਨਲ ਫੇਵਰੇਟ ਮਿੱਥ ਜਿਹੜਾ ਮੇਰਾ ਛੋਟੀ ਹੁੰਦੀ ਦਾ ਹੁੰਦਾ ਸੀ ਉਹ ਹੈਗਾ ਜਦੋਂ ਮੈਂ ਆਈ ਥਿੰਕ ਫੋਰਥ ਕਲਾਸ 'ਚ ਹੋਊਂਗੀ ਉਦੋਂ ਅਸੀਂ ਮਤਲਬ ਵਿਹੜੇ ਵਿੱਚ ਪੈਂਦੇ ਹੁੰਦੇ ਸੀ ਤਾਰਿਆਂ ਦੀ ਛਾਂ ਹੇਠਾਂ ਤਾਂ ਮੈਂ ਹਮੇਸ਼ਾ ਆਪਦੀ ਪੇਰੈਂਟਸ ਨੂੰ ਆਪਦੇ ਦਾਦੀ ਨੂੰ ਪੁੱਛਦੀ ਹੁੰਦੀ ਸੀ ਵੀ ਇਹ ਤਾਰੇ ਕਿੱਥੋਂ ਆਏ ਹੈ ਇਹ ਐਨੇ ਚਮਕਦੇ ਕਿਉਂ ਆਂ ਮਤਲਬ ਬਹੁਤ ਸਾਰੇ ਸਵਾਲ ਜਿਵੇਂ ਆਪਾਂ ਛੋਟੇ ਹੁੰਦੇ ਪੁੱਛਦੇ ਹੁੰਦੇ ਸੀ ਕਿਉਂਕਿ ਐਗਜੈਕਟਲੀ ਮੈਨੂੰ ਯਾਦ ਨਹੀਂ ਹੈਗਾ ਅਤੇ ਉਦੋਂ ਮੇਰੀ ਦਾਦੀ ਮੈਨੂੰ ਸਟੋਰੀ ਸੁਣਾਉਂਦੀ ਹੁੰਦੀ ਸੀ ਵੀ ਜਿਹੜੇ ਤਾਰੇ ਸੀ ਪਹਿਲਾਂ ਉਹ ਧਰਤੀ ਉੱਤੇ ਹੁੰਦੇ ਸੀ ਵੀ ਉਹ ਜਿਵੇਂ ਬੱਦਲ ਹੈ ਨਾ ਆਪਣੇ ਛੱਤ ਜਿੱਦਾਂ ਦੀਵੇ ਹੁੰਦੇ ਸੀ ਅਤੇ ਜਦੋਂ ਤਾਰੇ ਆਉਂਦੇ ਸੀ ਆਪਾਂ ਤਾਰਿਆਂ ਨੂੰ ਹੱਥ ਵੀ ਲਾ ਸਕਦੇ ਹੁੰਦੇ ਸੀ ਪਰ ਉਦੋਂ ਇਹ ਸੀਗਾ ਵੀ ਜੇ ਕਿਸੇ 'ਤੇ ਇਹ ਵਰਦਾਨ ਹੀ ਸੀਗਾ ਉਦੋਂ ਵੀ ਜੇ ਕਿਸੇ ਨੇ ਤਾਰਾ ਤੋੜਿਆ ਤਾਂ ਤੁਹਾਡੇ ਤੋਂ ਦੂਰ ਚਲੇ ਜਾਣਗੇ ਇੱਦਾਂ ਹੀ ਵੀ ਇੱਕ ਕੁੜੀ ਨੇ ਐਕਸਪੈਰੀਮੈਂਟ ਕਰਨ ਲਈ ਤਾਰੇ ਨੂੰ ਤੋੜਤਾ ਅਤੇ ਉਹ ਸੱਚੀ ਉੱਪਰ ਚਲੇ ਗਏ ਅਤੇ ਤਾਂ ਕਰਕੇ ਹੁਣ ਇਹ ਆਪਣੇ ਤੋਂ ਇੰਨੇ ਦੂਰ ਹੈ ਉਸ ਟਾਈਮ ਛੋਟੇ ਹੁੰਦੇ ਸੀ ਨਾ ਆਪਾਂ ਨੂੰ ਇੰਨਾ ਪਤਾ ਸੀ ਤਾਂ ਮੈਂ ਸੋਚ ਲਿਆ ਕੀ ਹਾਂ ਸ਼ਾਇਦ ਇਹੀ ਹੋ ਸਕਦਾ ਮੈਂ ਹਮੇਸ਼ਾ ਇਹੀ ਸੋਚਦੀ ਰਹਿੰਦੀ ਵੀ ਜਦੋਂ ਤਾਰੇ ਥੱਲੇ ਹੁੰਦੇ ਤਾਂ ਕਿੱਡੇ ਸੋਹਣੇ ਲੱਗਦੇ ਸੀ ਪਰ ਜਿਵੇਂ ਜਿਵੇਂ ਵੱਡੇ ਹੋਏ ਆਪਾਂ ਸਾਇੰਸ ਪੜ੍ਹੀ ਆਪਾਂ ਨੂੰ ਪਤਾ ਲੱਗਿਆ ਵੀ ਰਿਐਲਿਟੀ ਤਾਂ ਕੁਛ ਹੋਰ ਹੀ ਹੈ ਵੀ ਇਹ ਵਾਲੀ ਸਟੋਰੀ ਹੀ ਸੀ ਸਿਰਫ ਅੰਧ ਵਿਸ਼ਵਾਸ ਸੀ ਵੀ ਰਿਐਲਿਟੀ ਵਿੱਚ ਇਹੋ ਜਿਹਾ ਕੁਛ ਵੀ ਪੋਸੀਬਲ ਨੀਗਾ ਅਤੇ ਉਹਦੇ ਕਰਕੇ ਵੀ ਆਪਾਂ ਨੂੰ ਪਤਾ ਲੱਗਿਆ ਵੀ ਇਹ ਤਾਰੇ ਸਿਰਫ ਇੱਕ ਪੱਥਰ ਹੁੰਦੇ ਆ ਜਿਹੜੇ ਧਰਤੀ 'ਚ ਇੱਦਾਂ ਹੀ ਤੁਰੇ ਫਿਰਦੇ ਹੁੰਦੇ ਆ ਤਾਂ ਆਪਣੇ ਰਾਤ ਨੂੰ ਚਮਕਦੇ ਹੁੰਦੇ ਆ ਅਤੇ ਇੱਕ ਦੂਸਰੀ ਕਹਾਣੀ ਵੀ ਸੀ ਵੀ ਤਾਰੇ ਜਿਹੜਾ ਬੰਦਾ ਮਰ ਜਾਂਦਾ ਉਹ ਮਰਨ ਤੋਂ ਬਾਅਦ ਤਾਰਾ ਬਣਦਾ ਉਹੀ ਵੀ ਜਦੋਂ ਮੇਰੇ ਦਾਦਾ ਜੀ ਦੀ ਡੈਥ ਹੋਈ ਸੀ ਉਦੋਂ ਮਤਲਬ ਅਸੀਂ ਮਿਸ ਕਰਦੇ ਹੁੰਦੇ ਸੀ ਇਸ ਕਰਕੇ ਮੇਰੇ ਪੇਰੈਂਟਸ ਮੈਨੂੰ ਕਹਿੰਦੇ ਹੁੰਦੇ ਸੀ ਰਾਤ ਨੂੰ ਵੀ ਉਹ ਵੇਖ ਉਹ ਸੀ ਤੇਰੇ ਦਾਦਾ ਜੀ ਜਿਹੜੇ ਸਭ ਤੋਂ ਜ਼ਿਆਦਾ ਚਮਕੇ ਹੁੰਦੇ ਉਸ ਟਾਈਮ ਤੈਨੂੰ ਹੀ ਵੇਖ ਰਹੇ ਆ ਇਸ ਕਰਕੇ ਤੂੰ ਉਦਾਸ ਨਾ ਹੋ ਕਿਉਂਕਿ ਜੇ ਤੂੰ ਉਦਾਸ ਹੋਏਗੀ ਤਾਂ ਫਿਰ ਉਹਨਾਂ ਨੂੰ ਵੀ ਬੁਰਾ ਫੀਲ ਹੋਊਗਾ ਅਤੇ ਇਹੀ ਹਮੇਸ਼ਾ ਇਹੀ ਇਹੀ ਮੰਨਿਆ ਜਾਂਦਾ ਸੀ ਵੀ ਜਿਹੜਾ ਵੀ ਬੰਦਾ ਮਰ ਜਾਂਦਾ ਮਰਨ ਤੋਂ ਬਾਅਦ ਉਹ ਤਾਰਾ ਬਣ ਜਾਂਦਾ ਅਤੇ ਤੁਹਾਨੂੰ ਹਮੇਸ਼ਾ ਵੇਖਦਾ ਵੀ ਤੁਸੀਂ ਕੀ ਕਰਦੇ ਹੋ ਕੀ ਉਹਨਾਂ ਨੂੰ ਯਾਦ ਕਰਦੇ ਹੋ ਜਾਂ ਕੁਛ ਵੀ ਅਤੇ ਬਾਅਦ ਵਿੱਚ ਉਹੀ ਗੱਲ ਵੀ ਜਦੋਂ ਆਪਾਂ ਵੱਡੇ ਹੋਏ ਆਪਾਂ ਨੂੰ ਪਤਾ ਲੱਗਿਆ ਤਾਂ ਆਪਾਂ ਨੂੰ ਰਿਐਲਿਟੀ ਵੀ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਪਰ ਇਹ ਦੋ ਕਹਾਣੀਆਂ ਮੈਨੂੰ ਚੇਤੇ ਹੈ ਅਤੇ ਇਹੀ ਦੋ ਕਹਾਣੀਆਂ ਮੇਰੀਆਂ ਫੇਵਰੇਟ ਸੀ ਛੋਟੇ ਹੁੰਦੇ